ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰਤ ਵਿੱਚ ਨਵੀਆਂ ਨੌਕਰੀਆਂ ਅਤੇ ਭੂਮਿਕਾਵਾਂ ਦਾ ਉਭਾਰ ਹੋਇਆ ਹੈ ਇਹਦੇ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਜੋ ਸੰਭਾਵਨਾ ਉਭਰੀਆਂ ਹਨ ਉਹਦੇ ਵਿੱਚ ਯੂਟਿਊਬਰ ਬਣ ਕੇ ਵੀ ਕਮਾਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਮੱਗਰੀ ਨਿਰਮਾਤਾ ਦੇ ਤੌਰ 'ਤੇ ਵੀ ਕਾਰਜ ਜਾਂ ਕਾਰ ਵਿਹਾਰ ਸ਼ੁਰੂ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕਮੇਡੀਅਨ ਦੇ ਤੌਰ 'ਤੇ ਹਾਸਰਸ ਕਲਾਕਾਰ ਦੇ ਤੌਰ 'ਤੇ ਗੀਤਕਾਰ ਦੇ ਤੌਰ 'ਤੇ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਜੋ ਕਿ ਯਾਤਰਾ ਨਾਲ ਜੁੜੀਆਂ ਹੋਈਆਂ ਨੇ ਉਹਦੇ ਵਿੱਚ ਹੋਟਲ ਸੇਵਾਵਾਂ ਭੋਜਨ ਨਾਲ ਸਬੰਧੀ ਜੋ ਕੰਮ ਨੇ ਉਹਨਾਂ ਦਾ ਉਭਾਰ ਹੋਇਆ ਹੈ ਜਿਹਦੇ ਵਿੱਚ ਫਾਸਟ ਫੂਡ ਸਬੰਧੀ ਬਹੁਤ ਤੇਜ਼ੀ ਨਾਲ ਜੋ ਨੌਜਵਾਨਾਂ ਦਾ ਰੁਝਾਨ ਵੱਧ ਰਿਹਾ ਹੈ ਇਸ ਤੋਂ ਇਲਾਵਾ ਅੱਜ ਦਾ ਨੌਜਵਾਨ ਜ਼ਿੰਦਗੀ ਦੇ ਵਿੱਚ ਜੋ ਬਹੁਤ ਘੱਟ ਸਮੇਂ ਵਿੱਚ ਵੱਡੀ ਤਰੱਕੀ ਵੱਲ ਸੋਚ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਕਾਮਯਾਬੀ ਲਈ ਸਮਾਂ ਲੱਗਦਾ ਹੈ ਅਤੇ ਹੌਲੇ ਹੌਲੇ ਆਰਾਮ ਨਾਲ ਜਿਹੜਾ ਹੈ ਆਪਣੀ ਮੰਜ਼ਿਲ ਵੱਲ ਵਧਿਆ ਜਾ ਸਕਦਾ ਹੈ